ਫਤਿਹਗੜ੍ਹ ਸਾਹਿਬ ਇੱਕ ਬਹੁਤ ਹੀ ਜ਼ਿਆਦਾ ਵਧੀਆ ਜ਼ਿਲ੍ਹਾ ਆ ਮਤਲਬ ਕਿ ਇੱਥੋਂ ਦੇ ਲੋਕਾਂ ਨੂੰ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਬਹੁਤ ਘੱਟ ਕਰਨਾ ਪੈਂਦਾ ਨੇ ਪਰ ਹਾਲਾਂਕਿ ਇੱਥੇ ਕੁਝ ਬਹੁਤ ਹੈਗੀਆਂ ਨੇ ਚੁਣੌਤੀਆਂ ਜਿਨ੍ਹਾਂ ਦਾ ਸੰਬ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਜਿਵੇਂ ਕਿ ਜਿਹੜੇ ਜ਼ਿਆਦਾ ਏਜ਼ਡ ਲੋਕ ਨੇ ਉਹਨਾਂ ਨੂੰ ਮਤਲਬ ਕਿ ਕਈ ਵਾਰ ਆਪਾਂ ਜਿਵੇਂ ਕਹਿ ਦਿੰਦੇ ਹਾਂ ਉਹਨਾਂ ਦੀ ਹੈਲਥ ਦੇ ਰਿਗਾਰਡਿੰਗ ਉਹਨਾਂ ਨੂੰ ਪ੍ਰੋਬਲਮਸ ਦੇਖਣੀਆਂ ਪੈਂਦੀਆਂ ਨੇ ਵੀ ਕਈ ਵਾਰ ਮਤਲਬ ਕਿ ਮੈਡੀਕੇਸ਼ਨ ਜਿਹੜੀ ਫੈਸਲਿਟੀਜ ਨੇ ਬਹੁਤ ਜ਼ਿਆਦਾ ਵਧੀਆ ਨੇ ਪਰ ਕਈ ਵਾਰੀ ਇੱਥੇ ਮੈਡੀਕੇਸ਼ਨ ਫੈਸਿਲਿਟੀ ਜਦੋਂ ਕਦੇ ਕੋਈ ਫਲੱਡ ਆ ਜਾਵੇ ਜਾਂ ਫਿਰ ਕੋਈ ਆਫਤ ਕਾਲੀਨ ਸਮੱਸਿਆ ਆ ਜਾਵੇ ਤਾਂ ਉਦੋਂ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਜਾਂਦੀਆਂ ਨੇ ਅਤੇ ਮਤਲਬ ਕਿ ਸਰਕਾਰ ਨੂੰ ਚਾਹੀਦਾ ਆ ਕਿ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰੇ ਜਿਵੇਂ ਹੁਣ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਨੇ ਤਾਂ ਲੋਕ ਨੇ ਜਿਹੜੇ ਮਤਲਬ ਕਿ ਆਪਣੇ ਮੈਡੀਟੇਸ਼ਨ ਵਾਸਤੇ ਜਾਂ ਪ੍ਰੇਅਰ ਕਰਨ ਵਾਸਤੇ ਗੁਰਦੁਆਰਿਆਂ ਵਿੱਚ ਜਾਂਦੇ ਨੇ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਨੇ ਤਾਂ ਕਰਕੇ ਇੱਥੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਘੱਟ ਚੁਣੌਤੀਆਂ ਪੂਰਨ ਸਹਿਣੀਆਂ ਪੈਂਦੀਆਂ ਨੇ ਸੋ ਦੇਖ ਰੇਖ ਦੇ ਵਿੱਚ ਅਤੇ ਸਾਹਿਤਕ ਸੰਬੰਧ ਵਿੱਚ ਫਤਿਹਗੜ੍ਹ ਸਾਹਿਬ ਬਹੁਤ ਹੀ ਜ਼ਿਆਦਾ ਵਧੀਆ ਜ਼ਿਲ੍ਹਾ ਹੈ